ਸਿੱਖ ਧਰਮ ਦੁਨੀਆਂ ਦੇ ਨਕਸ਼ੇ ਦੇ ਉੱਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਨਾਲ ਪ੍ਰਗਟ ਹੁੰਦਾ ਹੈ ਇਸ ਦੀਆਂ ਜੋ ਵਿਲੱਖਣ ਵਿਸ਼ੇਸ਼ਤਾਵਾਂ ਜੋ ਹਨ ਉਹ ਹਨ ਕਿਰਤ ਕਰੋ ਨਾਮ ਜਪੋ ਵੰਡ ਛਕੋ ਅਤੇ ਨਾਲ ਹੀ ਗੁਰਬਾਣੀ ਜਾ ਦਾ ਗੁਰਬਾਣੀ ਦਾ ਜੋ ਸੁਨੇਹਾ ਹੈ ਸਭੇ ਸਾਂਝੀਵਾਲ ਸਦਾਇਨਿ ਤੂੰ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ਅਨੁਸਾਰ ਸਾਰੀ ਹੀ ਲੁਕਾਈ ਦੇ ਜੋ ਵੱਖ ਵੱਖ ਖੇਤਰਾਂ ਤੋਂ ਵੱਖ ਵੱਖ ਦੇਸ਼ਾਂ ਤੋਂ ਵੱਖ ਵੱਖ ਭਾਸ਼ਾਵਾਂ ਤੋਂ ਵੱਖ ਵੱਖ ਖਿੱਤਿਆਂ ਤੋਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਅਤੇ ਉਹਨਾਂ ਦੇ ਭਲੇ ਦੀ ਲੋਚਨਾ ਕਰਨੀ ਅਰਦਾਸ ਕਰਨੀ ਇਹ ਜੋ ਵਿਸ਼ੇਸ਼ਤਾ ਹੈ ਇਸ ਖਿੱਤੇ ਦੇ ਧਰਮ ਦੀ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਹਨ ਪੰਜਾਬ ਜਿਊਂਦਾ ਗੁਰਾਂ ਦੇ ਨਾਂ 'ਤੇ ਅਤੇ ਇਸ ਤੋਂ ਇਲਾਵਾ ਜੋ ਵਿਰਾਸਤੀ ਦਿੱਖ ਜੋ ਇਤਿਹਾਸਿਕ ਤੌਰ 'ਤੇ ਜੋ ਸਿੱਖਾਂ ਨੂੰ ਦਿੱਤੀ ਉਹਨਾਂ ਦੇ ਸਿਰ ਦੇ ਉੱਤੇ ਜੋ ਦਸਤਾਰ ਹੈ ਸੋਹਣੀ ਪੱਗੜੀ ਹੈ ਅਤੇ ਉਹਨਾਂ ਦਾ ਜੋ ਸਭ ਨੂੰ ਸਨੇਹ ਦੇ ਨਾਲ ਪਿਆਰ ਦੇ ਨਾਲ ਮਿਲਣਾ ਹੈ ਅਤੇ ਉਸਦਾ ਪ੍ਰਗਟਾਵਾ ਵੱਖ ਵੱਖ ਤਿਉਹਾਰਾਂ ਦੇ ਨਾਲ ਉਹ ਪ੍ਰਗਟ ਹੁੰਦਾ ਰਹਿੰਦਾ ਹੈ ਭਾਵੇਂ ਗੁਰਪੁਰਬ ਹੋਣ ਵਿਸਾਖੀ ਦਾ ਪਵਿੱਤਰ ਦਿਹਾੜਾ ਹੋਵੇ ਜਦੋਂ ਗੁਰੂ ਸਾਹਿਬ ਖਾਲਸੇ ਨੂੰ ਇਸ ਧਰਤੀ ਦੇ ਉੱਤੇ ਪ੍ਰਗਟ ਕਰਦੇ ਹਨ ਸੋ ਇਹ ਕੇਵਲ ਪੰਜਾਬ ਜਾਂ ਭਾਰਤ ਜਾਂ ਏਸ਼ੀਆ ਹੀ ਨਹੀਂ ਪੂਰੀ ਦੁਨੀਆਂ ਦੇ ਜੋ ਦੇਸ਼ਾਂ ਦੇ ਵਿੱਚ ਆਪਣੀ ਖੁਸ਼ਬੂ ਵੰਡ ਰਿਹਾ ਹੈ ਖਾਸ ਤੌਰ ਦੇ ਉੱਤੇ ਜਦੋਂ ਮਨੁੱਖਤਾ ਨੂੰ ਵੱਖ ਵੱਖ ਦੇਸ਼ਾਂ ਵਿੱਚ ਵਸ ਰਹੇ ਲੋਕਾਂ ਨੂੰ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਹਨ ਤਾਂ ਇਸ ਧਰਮ ਦੇ ਪੈਰੋਕਾਰ ਉੱਥੇ ਪਹੁੰਚ ਕੇ ਉਹਨਾਂ ਨੂੰ ਜੋ ਰਾਹਤ ਪ੍ਰਦਾਨ ਕਰਦੇ ਹਨ ਉਹਨਾਂ ਦਾ ਦੁੱਖ ਸਾਂਝਾ ਕਰਦੇ ਹਨ ਅਤੇ ਹਰ ਸੰਭਵ ਕੋਸ਼ਿਸ਼ ਕਰਦੇ ਹਨ ਕਿ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ ਜਾ ਸਕੇ